ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸਥਿਤੀ ਦੇ ਰੂਪ ਵਿੱਚ ਪਠਾਨਕੋਟ ਜ਼ਿਲੇ ਵਿੱਚ ਔਰਤਾਂ ਨੂੰ ਬਹੁਤ ਸਾਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਤੇ ਇਕੱਲੇ ਆਉਣਾ ਜਾਣਾ ਹੋਵੇ ਤਾਂ ਵੀ ਔਰਤ ਨੂੰ ਬਹੁਤ ਸਫ਼ਰ ਕਰਨਾ ਪੈਂਦਾ ਹੈ ਬੱਸ ਵਿੱਚ ਸਫ਼ਰ ਕਰਦੀ ਔਰਤ ਨੂੰ ਹਰ ਕੋਈ ਗੰਦੀ ਨਜ਼ਰ ਨਾਲ ਵੇਖਦਾ ਹੈ ਅਤੇ ਇਸ ਨੂੰ ਸੈਨਤਾਂ ਮਾਰਦਾ ਹੈ ਅਤੇ ਜੇ ਕਿਤੇ ਔਰਤ ਛੋਟੇ ਕੱਪੜੇ ਪਾ ਲਵੇ ਤਾਂ ਵੀ ਉਸ ਨੂੰ ਹਰ ਕੋਈ ਗੰਦੀ ਨਜ਼ਰ ਨਾਲ ਦੇਖ ਕੇ ਸੈਨਤਾ ਮਾਰਦਾ ਹੈ ਔਰਤ ਦਾ ਜੋਬ ਕਰਨਾ ਵੀ ਕੋਈ ਪਸੰਦ ਨਹੀਂ ਕਰਦੇ ਘਰ ਦੇ ਵੀ ਉਸ ਦਾ ਵਿਆਹ ਕਰਵਾ ਦਿੰਦੇ ਹਨ ਅਤੇ ਉਸ ਨੂੰ ਜੋਬ ਨਹੀਂ ਕਰਨ ਦਿੰਦੇ ਅੱਜ ਦੀ ਔਰਤ ਘਰ ਦੇ ਕੰਮਾਂ ਦੇ ਨਾਲ ਨਾਲ ਜੋਬ ਵੀ ਕਰ ਸਕਦੀ ਹੈ ਉਹ ਹੋਰ ਵੀ ਬਹੁਤ ਕੁਛ ਕਰ ਸਕਦੀ ਹੈ ਪਰ ਘਰ ਦੇ ਉਸ ਦਾ ਸਾਥ ਨਹੀਂ ਦਿੰਦੇ ਅਤੇ ਉਸ ਦਾ ਵਿਆਹ ਜਲਦੀ ਜਲਦੀ ਕਰ ਦਿੰਦੇ ਹਨ ਪਰ ਔਰਤ ਵਿਚਾਰੀ ਆਪਣਾ ਮਨ ਮਾਰ ਕੇ ਵਿਆਹ ਕਰ ਲੈਂਦੀ ਹੈ ਪਰ ਅੱਗੇ ਵੀ ਉਸ ਨੂੰ ਬਹੁਤ ਸਾਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਰਦ ਵੀ ਉਸ ਨੂੰ ਘਰ ਦੇ ਕੰਮਾਂ ਵਿੱਚ ਹੀ ਰਜਾਈ ਰੱਖਦਾ ਹੈ ਅਤੇ ਉਸ ਨਾਲ ਕੋਈ ਹੈਲਪ ਨਹੀਂ ਕਰਵਾਉਂਦਾ ਅਤੇ ਔਰਤ ਵਿਚਾਰੀ ਘਰ ਵਾਸਤੇ ਹੀ ਰਹਿ ਜਾਂਦੀ ਹੈ ਅਤੇ ਹਰ ਕੋਈ ਉਸ ਨੂੰ ਮੁੰਡੇ ਦੀ ਹੀ ਰਟ ਲਗਾਏ ਰੱਖਦਾ ਹੈ ਕਿ ਮੁੰਡਾ ਹੀ ਚਾਹੀਦਾ ਹੈ ਅਤੇ ਕੋਈ ਉਸ ਤੋਂ ਦਹੇਜ ਮੰਗਦਾ ਹੈ ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਔਰਤ ਨੂੰ ਸਨਮਾਨ ਦੇ ਰੂਪ ਵਿੱਚ ਨਹੀਂ ਦਿੱਤਾ ਜਾਂਦਾ ਔਰਤ ਨੂੰ ਵੀ ਸਨਮਾਨ ਦਾ ਵਿਤਕਰਾ ਮਿਲਣਾ ਚਾਹੀਦਾ ਹੈ ਇਹ ਗੱਲ ਸਭ ਨੂੰ ਸਮਝਣੀ ਚਾਹੀਦੀ ਹੈ ਅਤੇ ਔਰਤ ਨੂੰ ਵੀ ਕੁਛ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਇਹ ਕੋਈ ਨਹੀਂ ਸਮਝਦਾ ਕਿ ਔਰਤ ਵੀ ਹਰ ਇੱਕ ਕੰਮ ਕਰ ਸਕਦੀ ਹੈ ਪਰ ਫਿਰ ਵੀ ਔਰਤ ਆਪਣਾ ਮਨ ਮਾਰ ਕੇ ਸਾਰੇ ਕੰਮਾਂ ਵਿੱਚ ਰੁੱਝ ਜਾਂਦੀ ਹੈ ਧੰਨਵਾਦ